ਕੀ ਸ਼ਾਮ ਸੁੰਦਰ ਢਾਬੇ ਤੋਂ ਗੱਲ ਕਰ ਰਹੇ ਹੋ ਤਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਅਸੀਂ ਇੱਕ ਟੇਬਲ ਬੁੱਕ ਕਰਵਾਉਣਾ ਹੈ ਕੱਲ੍ਹ ਲਈ ਤਾਂ ਟੇਬਲ ਬੁੱਕ ਕਰਵਾਉਣ ਲਈ ਕੀ ਤੁਹਾਡੀਆਂ ਕੰਡੀਸ਼ਨਸ ਹਨ ਸ਼ਰਤਾਂ ਹਨ ਉਹ ਮੈਂ ਜਾਨਣਾ ਚਾਹੁੰਦੀ ਹਾਂ ਅਤੇ ਜੇਕਰ ਅਸੀਂ ਇੱਕ ਫੈਮਲੀ ਟੇਬਲ ਬੁੱਕ ਕਰਵਾਉਂਦੇ ਹਾਂ ਅਤੇ ਐਡਵਾਂਸ ਵਿੱਚ ਅਸੀਂ ਪੇਮੈਂਟ ਕਰਦੇ ਹਾਂ ਤਾਂ ਕੀ ਉਸ 'ਤੇ ਸਾਨੂੰ ਕੋਈ ਵਿਸ਼ੇਸ਼ ਆਫਰ ਦਿੱਤੇ ਜਾਣਗੇ ਜਾਂ ਫਿਰ ਖਾਣੇ ਵਿੱਚ ਕੁਛ ਵਿਸ਼ੇਸ਼ ਦਿੱਤਾ ਜਾਵੇਗਾ ਜਾਂ ਫਿਰ ਕਿਸੇ ਤਰ੍ਹਾਂ ਦੀ ਜੋ ਛੂਟ ਹੈ ਉਹ ਪੈਸਿਆਂ ਵਿੱਚ ਦਿੱਤੀ ਜਾਵੇਗੀ ਜਾਂ ਨਹੀਂ ਹਾਂ ਜੇਕਰ ਪਹਿਲਾਂ ਬੁਕਿੰਗ ਕਰਵਾਉਣ ਅਤੇ ਔਨ ਦੀ ਸਪੋਰਟ ਸਾਡੇ ਜਾਣ 'ਤੇ ਕੋਈ ਵਿਸ਼ੇਸ਼ ਪੇਸ਼ਕਸ਼ ਨਹੀਂ ਦਿੱਤੀ ਜਾਂਦੀ ਦੋਨਾਂ ਵਿੱਚ ਸਮਾਨ ਵਿਵਹਾਰ ਕੀਤਾ ਜਾਵੇਗਾ ਤਾਂ ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਕੋਈ ਵਿਸ਼ੇਸ਼ ਆਫਰ ਤੁਹਾਡੇ ਕੋਲ ਹਨ ਤਾਂ ਉਸ ਬਾਰੇ ਵੀ ਸਾਨੂੰ ਜਾਣੂ ਕਰਵਾਇਆ ਜਾਵੇ